ਸੈਲਾਨੀਆਂ ਨੂੰ ਸਾਡੇ ਪਕਵਾਨ ਬੜੇ ਚੰਗੇ ਲੱਗਦੇ ਹਨ ਜਿਵੇਂ ਸਾਗ ਸ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਅਤੇ ਮੂਲੀ ਮੱਖਣ ਲੱਸੀ ਸੀ ਇਹ ਇਹੋ ਜਿਹੇ ਆ ਭੋਜਨ ਖਾ ਕੇ ਬੜਾ ਪਸੰਦ ਕਰਦੇ ਹਨ ਜਾਂ ਫਿਰ ਮਸਾਲੇ ਵਾਲੀਆਂ ਚੀਜ਼ਾਂ ਜਿਵੇਂ ਸ਼ਾਕਾਹਾਰੀ ਮਾਸਾਹਾਰੀ ਇਹ ਚੀਜ਼ਾਂ ਬਣਾਏ ਹੋਏ ਖਾਂਦੇ ਖਾਣੀਆਂ ਬੜੀਆਂ ਪਸੰਦ ਕਰਦੇ ਹਨ ਕਿਵੇਂ ਮਾਸਾਹਾਰੀ ਨੇ ਉਸ ਨੂੰ ਮਾਸਾਹਾਰੀ ਦੇ ਮਸਾਲਿਆਂ ਨਾਲ ਚੰਗੀ ਤਰ੍ਹਾਂ ਬਣਾਇਆ ਜਾਂਦਾ ਅਤੇ ਉਹ ਬੜਾ ਵਧੀਆ ਕਰਦੇ ਆ ਕਿਵੇਂ ਹੋਰ ਵੀ ਚੀਜ਼ਾਂ ਕਿਵੇਂ ਕੁਲਫੀ ਕਿਵੇਂ ਸਾਡੇ ਕੁਲਫੀ ਆ ਸਮੋਸਾ ਸਾਡਾ ਸਮੋਸਾ ਸ਼ਿਵ ਸਾਦੀਆਂ ਦਾ ਬਹੁਤ ਚੰਗਾ ਲ ਬਹੁਤ ਵਧੀਆ ਅਤੇ ਅੱਛਾ ਹੁੰਦਾ ਹੈ ਜਾਂ ਕੁਲਫੀ ਆ ਸਾਡੇ ਨਾਮਧਾਰੀ ਜਾਂ ਉਹ ਕੁਲਫੀ ਡੰਡੇ ਵਾਲੀ ਕੁਲਫੀ ਆ ਉਹ ਬਹੁਤ ਵਧੀਆ ਮਸ਼ਹੂਰ ਆ ਅਤੇ ਖੋਏ ਵਾਲੀ ਕੁਲਫੀ ਆ ਉਹ ਵੀ ਬਹੁਤ ਮਸ਼ਹੂਰ ਆ ਇਹਨਾਂ ਨੂੰ ਖਾ ਕੇ ਸੈਲਾਨੀ ਆਪਣਾ ਬਹੁਤ ਦੂਰ ਤੱਕ ਅਤੇ ਆਉਣ ਵਾਲੇ ਸਮੇਂ ਤੱਕ ਯ ਯ ਯਾਦ ਕਰਦੇ ਹਨ